ਸਾਡੇ ਰਾਜ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਬਹੁਤ ਹੀ ਭੂਮਿਕਾ ਨਿਭਾਉਂਦੀ ਹੈ ਅਤੇ ਬੋਲਣ ਵਿੱਚ ਵੀ ਅਸਾਨ ਹੁੰਦੀ ਹੈ ਅਤੇ ਬਹੁਤ ਹੀ ਵਧੀਆ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਇਸਨੂੰ ਬੋਲਣਾ ਬਹੁਤ ਹੀ ਆਸਾਨ ਹੈ ਅਤੇ ਹੋਰ ਭਾਸ਼ਾਵਾ ਨਾਲੋਂ ਬਹੁਤ ਹੀ ਸੌਖੀ ਹੈ ਅਤੇ ਇਸਨੂੰ ਬੱਚੇ ਵੀ ਬਥੇਰੀ ਵਧੀਆ ਤਰੀਕੇ ਨਾਲ਼ ਬੋਲ ਸਕਦੇ ਹਨ ਅਤੇ ਅਸੀਂ ਇਨ੍ਹਾਂ ਦੀ ਬਹੁਤ ਹੀ ਵਧੀਆ ਤਰੀਕੇ ਨਾਲ਼ ਪੰਜਾਬੀ ਵਿੱਚ ਕਈ ਥਾਵਾਂ 'ਤੇ ਇੰਟਰਵਿਊਆਂ ਦੇ ਸਕਦੇ ਹਾਂ